ਸਾਡੇ ਰੂਪਨਗਰ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਕਿ ਪੇਂਡੂ ਔਰਤਾਂ ਨੂੰ ਸਿੱਖਿਆ ਅਤੇ ਕੰਮ ਕਰਨ ਦੀ ਮਦਦ ਕਰਦੀਆਂ ਹਨ ਸਾਡੀ ਜੋ ਸਰਕਾਰ ਹੈ ਉਹ ਔਰਤਾਂ ਦੇ ਹੱਕ ਵਿੱਚ ਜ਼ਿਆਦਾ ਹੁੰਦੀ ਹੈ ਕਿਉਂਕਿ ਔਰਤਾਂ ਸਿਰਫ਼ ਘਰ ਦੇ ਜੋਗੀਆਂ ਹੁੰਦੀਆਂ ਹਨ ਇਸ ਕਰਕੇ ਸਰਕਾਰ ਔਰਤਾਂ ਲਈ ਬਹੁਤ ਸਾਰੀਆਂ ਸੰਸਥਾਵਾਂ ਚਲਾਉਂਦੀ ਹੈ ਜਿਸਦੇ ਲਈ ਇੱਕ ਪੇਂਡੂ ਔਰਤ ਸਿਖ ਸਿਖਲਾਈ ਕਰ ਸਕੇ ਅਤੇ ਸਮਾਜ ਵਿੱਚ ਕੁਝ ਬਣ ਕੇ ਦਿਖਾ ਸਕੇ ਅਸੀਂ ਬਹੁਤ ਸਾਰੇ ਸਮਾਜ ਸੇਵਕਾਂ ਨੂੰ ਮਿਲੇ ਹਨ ਜੋ ਕਿ ਪੇਂਡੂ ਲੋਕਾਂ ਨੂੰ ਹੁਨਰਮੰਦ ਅਤੇ ਰੁਜ਼ਗਾਰ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਮਦਦ ਕਰਦੇ ਹਨ ਉਹਨਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਜੀ ਸੀਗੇ ਜੋ ਸਾਡੇ ਸਕੂਲ ਵਿੱਚ ਆਏ ਸੀ ਉਹਨਾਂ ਨੇ ਔਰਤਾਂ ਲਈ ਕਾਫੀ ਸਾਰੀਆਂ ਸੰਸਥਾਵਾਂ ਬਾਰੇ ਦੱਸਿਆ ਅਤੇ ਮੈਂ ਖੁਦ ਸਰਕਾਰੀ ਸਕੂਲ ਵਿੱਚ ਪੜ੍ਹਦੀ ਹਾਂ ਜੋ ਕਿ ਸਰਕਾਰੀ ਗਰਲਜ਼ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿੱਚ ਹੈ ਅਤੇ ਮੈਨੂੰ ਇਸ ਸਕੂਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਉਰੇ ਦੇ ਹਰੇਕ ਚੀਜ਼ ਬਹੁਤ ਵਧੀਆ ਹੈ ਵੀ ਬਹੁਤ ਅੱਛਾ ਹੈ ਸਟੱਡੀ ਵੀ ਬਹੁਤ ਅੱਛੀ ਹੈ ਅਤੇ ਇਹ ਸਾਰਾ ਕੁਝ ਸਰਕਾਰ ਵੱਲੋਂ ਹੀ ਕਰਵਾਇਆ ਗਿਆ ਹੈ ਅਤੇ